ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਬਹੁਤ ਫ਼ਰਕ ਪੈਂਦਾ ਹੈ ਪੈਟਰੋਲ ਸੌ ਰੁਪਏ ਲੀਟਰ ਜਾ ਰਿਹਾ ਹੈ ਜੋ ਕਿ ਬਹੁਤ ਮੁਸ਼ਕਿਲ ਹੈ ਮਾ ਮਾੜੇ ਬੰਦੇ ਲਈ ਪਾਉਣਾ ਪੈਟਰੋਲ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ ਸਰਕਾਰ ਦਾਅਵੇ ਕਈ ਕਰ ਦਿੰਦੀ ਹੈ ਪਰ ਪੈਟਰੋਲ ਬਹੁਤ ਮਹਿੰਗਾ ਹੋ ਗਿਆ ਹੈ ਕੁਝ ਸਾਲਾਂ ਵਿੱਚ ਪਹਿਲਾਂ ਚਾਲ੍ਹੀ ਪੰਜਾਹ ਰੁਪਏ ਹੁੰਦਾ ਸੀ ਹੁਣ ਸੌ ਰੁਪਏ ਚਲਾ ਗਿਆ ਹੈ ਪੈਟਰੋਲ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਜੋ ਬਾਈਕ ਦੇ ਅਤੇ ਜਿਹਨਾਂ ਨੇ ਡੇਲੀ ਜਾਣਾ ਹੁੰਦਾ ਹੈ ਉਹਨਾਂ ਨੂੰ ਕੁਛ ਫ਼ਰਕ ਪਵੇ ਬਾਲਣ ਦੀ ਜ਼ਿਆਦਾ ਵਰਤੋਂ ਬਹੁਤ ਨੁਕਸਾਨਦਾਇਕ ਹੈ ਇਸ ਨਾਲ਼ ਪ੍ਰਦੂਸ਼ਣ ਫੈਲਦਾ ਹੈ ਇਸ ਲਈ ਬਾਲਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਕ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਹੋ ਜਿਹਾ ਪ੍ਰਦੂਸ਼ਣ ਨਾ ਫੈਲੇ ਪਰ ਕੋਈ ਹੱਟ ਕੋਈ ਕਿਸੇ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਉਹ ਬ ਆਪਣੀ ਕਰਦੇ ਹਨ ਪਰ ਬਾਲਣ ਨਾਲ਼ ਪ੍ਰਦੂਸ਼ਣ ਅਤੇ ਬਹੁਤ ਧੂੰਆ ਫੈਲਦਾ ਹੈ ਜੋ ਕਿ ਸਭ ਦਿਆਂ ਲਈ ਨੁਕਸਾਨਦਾਇਕ ਹੈ ਇਸ ਲਈ ਮੇਰੀ ਕਹਿਣਾ ਤਾਂ ਇਹ ਹੈ ਬਾਲਣ ਦੀ ਵਰਤੋਂ ਘੱਟ ਤੋਂ ਘੱਟ ਤੋਂ ਘੱਟ ਕਰੋ ਤਾਂ ਕਿ ਜੋ ਕਿਸੇ ਲਈ ਨੁਕਸਾਨਦਾਇਕ ਨਾ ਹੋਵੇ ਪੈਟਰੋਲ ਦਾ ਦੀਆਂ ਕੀਮਤਾਂ ਬਾਰੇ ਵੀ ਜੋ ਕਿ ਬਹੁਤ ਵੱਧ ਗਈਆਂ ਹਨ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਤਾਂ ਕੀਮਤ ਪੈਟਰੋਲ ਦੀ ਘੱਟ ਹੋਣੀ ਚਾਹੀਦੀ ਹੈ ਤਾਂ ਕਿ ਜੋ ਆਮ ਬੰਦਾ ਆਰਾਮ ਨਾਲ਼ ਪਵਾ ਸਕੇ ਉਸਨੂੰ ਕੋਈ ਪਰੇਸ਼ਾਨੀ ਮੁਸ਼ਕਿਲ ਨਾ ਹੋਵੇ ਸੌ ਰੁਪਏ ਲੀਟਰ ਪੈਟਰੋਲ ਤਾਂ ਬਹੁਤ ਮਹਿੰਗਾ ਹੈ ਇਸ ਲਈ ਇਸਦੀ ਕੀਮਤ ਘੱਟ ਕੀਤੀ ਜਾਣੀ ਚਾਹੀਦੀ ਹੈ ਮੇਰਾ ਤਾਂ ਇਹੋ ਹੀ ਸੁਝਾਅ ਹੈ ਘੱਟ ਤੋਂ ਘੱਟ ਸੱਤਰ ਅੱਸੀ ਰੁਪਏ ਪੈਟਰੋਲ ਲੀਟਰ ਹੋਣਾ ਚਾਹੀਦਾ ਹੈ